ਮੇਰਾ ਨਾਮ ਅਰਾਧਨਾ ਹੈ ਮੈਂ ਪਠਾਨਕੋਟ ਜ਼ਿਲ੍ਹੇ ਵਿੱਚ ਰਹਿੰਦੀ ਹਾਂ ਅਸੀਂ ਇਹ ਗੱਲ ਕਰਦੇ ਹਾਂ ਬੁਣਨ ਅਤੇ ਸਿਲਾਈ ਕਰਨ ਦੀ ਦੇਖੋ ਪਹਿਲੇ ਤਾਂ ਹਰ ਕਿਸੇ ਨੂੰ ਕੰਮ ਸਿੱਖਣਾ ਪੈਂਦਾ ਹੈ ਪਹਿਲੇ ਮੈਂ ਪੜ੍ਹਾਈ ਕੀਤੀ ਉਸ ਤੋਂ ਬਾਅਦ ਮੈਂ ਸਿਲਾਈ ਕੀਤੀ ਸਿਲਾਈ ਕਰਨ ਵਿੱਚ ਮੈਨੂੰ ਬਹੁਤ ਹੀ ਮੁਸ਼ਕਿਲਾਂ ਵੀ ਆਈਆਂ ਅਤੇ ਮੈਨੂੰ ਬਹੁਤ ਹੀ ਮਜਾ ਵੀ ਆਇਆ ਜਦੋਂ ਮੈਂ ਸਿਲਾਈ ਸਿੱਖੀ ਤਾਂ ਮੈਂ ਆਪਣੇ ਮੈਡਮ ਕੋਲੋਂ ਬਹੁਤ ਕੁਝ ਸਿੱਖਿਆ ਪਹਿਲੇ ਅਸੀਂ ਉਹਨਾਂ ਕੋਲੋਂ ਥੋੜ੍ਹਾ ਬਹੁਤਾ ਕਰੋਸ਼ੀਆ ਚਲਾਉਣਾ ਸਿੱਖਿਆ ਅਤੇ ਅਸੀਂ ਸਿਲਾਈ ਵੀ ਬੁਣਨੀਆਂ ਸਿੱਖੀਆਂ ਉਹਦੇ ਬਾਅਦ ਅਸੀਂ ਸਾਨੂੰ ਉਹਨਾਂ ਨੇ ਕਿਹਾ ਤੁਸੀਂ ਪਹਿਲਾਂ ਅਖ਼ਬਾਰਾਂ ਲੈ ਕੇ ਆਓ ਅਤੇ ਤੁਹਾਨੂੰ ਅਸੀਂ ਅਖ਼ਬਾਰਾਂ 'ਤੇ ਕਟਿੰਗ ਕਰਨੀ ਸਿਖਾਵਾਂਗੇ ਜਦੋਂ ਅਸੀਂ ਕਟਾਈ ਕਰਨੀ ਸਿੱਖੀ ਤਾਂ ਸਾਨੂੰ ਉਸ ਨੇ ਪਹਿਲੇ ਕਿਹਾ ਵੀ ਤੁਸੀਂ ਅਖ਼ਬਾਰਾਂ 'ਤੇ ਹੀ ਸਿਲਾਈ ਕਰਨੀ ਹੈ ਸਾਨੂੰ ਉਹ ਕੰਮ ਬਹੁਤ ਹੀ ਔਖਾ ਲੱਗਿਆ ਕਿਉਂ ਔਖਾ ਲੱਗਿਆ ਜਦੋਂ ਅਸੀਂ ਅਖ਼ਬਾਰ ਨੂੰ ਸੀਂਦੇ ਸੀ ਤਾਂ ਅਖ਼ਬਾਰ ਬਹੁਤ ਜਲਦੀ ਫੱਟ ਜਾਂਦੀ ਸੀ ਉਸ ਤੋਂ ਬਾਅਦ ਉਸ ਨੇ ਕਿਹਾ ਕਿ ਅਖ਼ਬਾਰ 'ਤੇ ਸਿਓਣ ਲਈ ਅਸੀਂ ਤਾਂ ਸਿਖਾਉਂਦੇ ਹਾਂ ਕਿ ਤੁਹਾਡਾ ਕਿਤੇ ਕੱਪੜਾ ਨਾ ਖ਼ਰਾਬ ਹੋ ਜਾਵੇ ਅਸੀਂ ਸੋਚਿਆ ਵੀ ਚਲੋ ਮੈਡਮ ਜੋ ਕਹਿੰਦੀ ਹੈ ਠੀਕ ਕਰਦੀ ਹੈ ਅਸੀਂ ਥੋੜ੍ਹੇ ਦਿਨ ਅਖ਼ਬਾਰਾਂ ਲੈ ਕੇ ਜਾਂਦੇ ਸੀ ਫਿਰ ਸਾਨੂੰ ਉਸ ਨੇ ਹੌਲੀ ਹੌਲੀ ਕੱਪੜਾ ਲਿਆਣਾ ਸ਼ੁਰੂ ਕਰ ਤਾ ਅਸੀਂ ਕੱਪੜਾ ਲੈ ਕੇ ਜਾਣਾ ਉਸ ਨੇ ਸਾਨੂੰ ਕਟਿੰਗ ਸਿਖਾਉਣੀ ਜਦੋਂ ਅਸੀਂ ਕੱਪੜਾ ਕੱਟ ਲੈਣਾ ਫਿਰ ਅਸੀਂ ਉਸ ਨੂੰ ਮਸ਼ੀਨ 'ਤੇ ਸਿਲਣਾ ਅਤੇ ਸਾਨੂੰ ਬੜਾ ਹੀ ਮਜਾਂ ਆਉਣਾ ਉਸ ਤੋਂ ਬਾਅਦ ਅਸੀਂ ਕਿਸੇ ਦਿਨ ਕਰੋਸ਼ੀਆ ਬੁਣਨ ਲੱਗ ਪੈਣਾ ਕਿਸੇ ਦਿਨ ਅਸੀਂ ਸਿਲਾਈ ਕਰਨ ਸਿਲਾਈਆਂ ਬੁਣਨ ਲੱਗ ਪੈਣਾ ਕਿਸੇ ਦਿਨ ਅਸੀਂ ਕੱਪੜੇ ਸਿਓਣ ਲੱਗ ਪੈਣਾ ਹੌਲੀ ਹੌਲੀ ਕਰਦੇ ਕਰਦੇ ਸਾਨੂੰ ਇਹ ਬਹੁਤ ਸਮਾਂ ਲੱਗ ਗਿਆ ਅਤੇ ਉਸ ਤੋਂ ਬਾਅਦ ਫਿਰ ਮੈਡਮ ਨੇ ਕਿਹਾ ਤੁਸੀਂ ਹੁਣ ਬਹੁਤ ਕੁਝ ਸਿੱਖ ਚੁੱਕੇ ਹੋ ਅਤੇ ਤੁਸੀਂ ਹੁਣ ਆਪਣੇ ਪੇਪਰ ਵੀ ਦੇਵੋ ਅਸੀਂ ਫਿਰ ਪੇਪਰ ਦਿੱਤੇ ਕਰਦੇ ਕਰਦੇ ਸਾਨੂੰ ਇਹ ਤਿੰਨ ਸਾਲ ਲੱਗ ਗਏ ਫਿਰ ਮੈਡਮ ਕਹਿੰਦੀ ਕਿ ਤੁਹਾਡਾ ਹੁਣ ਇਹ ਤਿੰਨ ਸਾਲ ਦਾ ਡੇਟ ਪਲੀ ਡਿਪਲੋਮਾ ਹੋ ਗਿਆ ਹੈ ਜਦੋਂ ਅਸੀਂ ਤਿੰਨ ਸਾਲ ਦਾ ਡਿਪਲੋਮਾ ਕਰ ਗਿਆ ਕੋਰਸ ਕਰ ਲਿਆ ਤਾਂ ਫਿਰ ਸਾਨੂੰ ਅਸੀਂ ਆਪਣੇ ਘਰ ਚਲੇ ਗਏ ਪੇਪਰ ਦੇ ਕੇ ਅਸੀਂ ਆਪਣੇ ਘਰ ਆ ਗਏ ਉਸ ਤੋਂ ਬਾਅਦ ਜਦੋਂ ਅਸੀਂ ਥ ਥੋੜ੍ਹਾ ਬਹੁਤਾ ਕੰਮ ਕਰਨ ਲੱਗੇ ਕਦੀ ਕਿਸੇ ਦਾ ਸੂਟ ਸਿਓਣ ਲੱਗ ਪਏ ਕਦੀ ਕਿਸੇ ਦਾ ਸੂਟ ਸਿਓਣ ਲੱਗ ਪਏ ਸਾਨੂੰ ਬੜਾ ਹੀ ਮਜਾ ਆਉਂਦਾ ਸੀ ਅਸੀਂ ਜੋ ਕੱਪੜੇ ਪਾਉਂਦੇ ਹਾਂ ਅਸੀਂ ਆਪ ਸੀ ਕੇ ਪਾਉਂਦੇ ਹਾਂ ਉਸ ਤੋਂ ਬਾਅਦ ਫਿਰ ਮੈਂ ਸੋਚਿਆ ਵੀ ਅਸੀਂ ਕੰਮ ਕਿਹਦੇ ਵਾਸਤੇ ਸਿੱਖਿਆ ਜੇ ਅਸੀਂ ਕਰਾਂਗੇ ਨਹੀਂ ਸਾਨੂੰ ਸਿੱਖਣ ਦਾ ਕੋਈ ਫਾਇਦਾ ਨਹੀਂ ਫਿਰ ਮੈਂ ਥੋੜ੍ਹੀ ਜਿਹੀ ਲੜਕੀਆਂ ਨੂੰ ਪੁੱਛਿਆ ਕਿ ਤੁਸੀਂ ਕਿਸੇ ਨੇ ਕੱਪੜੇ ਸਿਲਨੇ ਸਿੱਖਣੇ ਹੈ ਅਤੇ ਲੜਕੀਆਂ ਕਹਿੰਦੀਆਂ ਹਾਂ ਸਾਨੂੰ ਤਾਂ ਬਹੁਤ ਚੰਗਾ ਲੱਗਿਆ ਹੈ ਤਾਂ ਮੈਂ ਕਿਹਾ ਠੀਕ ਹੈ ਤੁਸੀਂ ਸਾਡੇ ਘਰ ਆਇਓ ਅਸੀਂ ਤੁਹਾਨੂੰ ਕੱਪੜੇ ਸਿਲਨੇ ਅਤੇ ਕੱਟਣੇ ਸਿਖਾਵਾਂਗੇ ਫਿਰ ਹੌਲੀ ਹੌਲੀ ਕਰਦੇ ਸਾਡੀਆਂ ਸਾਰੀਆਂ ਲੜਕੀਆਂ ਸਾਡੇ ਘਰ ਆਉਣ ਲੱਗ ਪਈਆਂ ਅਤੇ ਅਸੀਂ ਉਹਨਾਂ ਨੂੰ ਸਿਲਾਈ ਸਿਖਾਉਣ ਲੱਗ ਪਏ ਜਦੋਂ ਅਸੀਂ ਉਹਨਾਂ ਨੂੰ ਸਿਲਾਈ ਸਿਖਾਉਂਦੇ ਸੀ ਤਾਂ ਅਸੀਂ ਬਹੁਤ ਹੀ ਮਜੇ ਕਰਦੇ ਸੀ ਕੁਛ ਟਾਈਮ ਵਾਸਤੇ ਅਸੀਂ ਸਿਲਾਈ ਸਿੱਖਣੀ ਉਹਦੇ ਬਾਅਦ ਅਸੀਂ ਕੁਛ ਖਾਣ ਪੀਣ ਲਈ ਮੰਗਵਾਉਣਾ ਅਸੀਂ ਇਕੱਠੇ ਬੈਠ ਕੇ ਖਾਣਾ ਸਾਨੂੰ ਇੰਨਾ ਮਜਾ ਆਉਂਦਾ ਸੀ ਕਿ ਅਸੀਂ ਤੁਹਾਨੂੰ ਕੁਛ ਦੱਸ ਵੀ ਨਹੀਂ ਸਕਦੇ ਇਹ ਸਾਡੇ ਬਹੁਤ ਹੀ ਯਾਦਗਾਰੀ ਪਲ ਹਨ ਜਿਹੜੇ ਅਸੀਂ ਤੁਹਾਡੇ ਨਾਲ ਸਾਂਝੇ ਕੀਤੇ ਹਨ